ਸਤਿ ਸ਼੍ਰੀ ਅਕਾਲ ਸਰ ਸਰ ਮੈਂ ਇੱਕ ਆਪਣਾ ਗੱਡੀ ਆਪਣਾ ਬੁੱਕ ਕਰਵਾਈ ਸੀਗੀ ਬਾਹਰ ਜਾਣ ਲਈ ਤੁਹਾਡਾ ਡਰਾਈਵਰ ਆਇਆ ਮੇਰੇ ਕੋਲ ਨਾ ਤਾਂ ਉਹਨਾਂ ਨੇ ਮਾਸਕ ਵਗੈਰਾ ਪਾਇਆ ਉਹਦੇ ਵਿੱਚ ਲਾਇਆ ਹੋਇਆ ਉਹਨਾਂ ਨੇ ਅਤੇ ਨਾ ਉਹ 'ਚ ਆਪਣਾ ਸੈਨੀਟਾਈਜ਼ਰ ਹੈ ਅਤੇ ਸੀਟਾਂ ਵੀ ਇੰਨੀਆਂ ਗੰਦੀਆਂ ਜਿੱਦਾਂ ਪਤਾ ਨਹੀਂ ਗੱਡੀ ਨੂੰ ਕਿੰਨੇ ਕੁ ਦਿਨ ਹੋ ਮਹੀਨੇ ਦਿਨ ਛੱਡੋ ਮਹੀਨੇ ਹੋ ਗਏ ਹੋਣਗੇ ਸਾਫ ਕਰੀ ਨੂੰ ਜਿਹੜੀ ਹਜੇ ਤੱਕ ਤੁਸੀਂ ਗੱਡੀ ਨਾ ਧੋਤੀ ਹੈ ਇੰਨਾ ਗੰਦ ਵੱਜਿਆ ਪਿਆ ਬੈਠਣ ਨੂੰ ਤਾਂ ਦਿਲ ਨਹੀਂ ਕਰਦਾ ਜਿੰਨੀ ਤੁਸੀਂ ਮੈਨੂੰ ਪੇਮੈਂਟ ਕਹੀ ਮੈਂ ਤੁਹਾਨੂੰ ਪੇਮੈਂਟ ਵੀ ਉੱਨੀ ਕਰੀ ਹੈ ਤਾਂ ਸਰ ਤੁਸੀਂ ਇੰਨੀ ਘਟੀਆ ਗੱਡੀ ਵੀ ਆਪਣਾ ਮੇਰੇ ਕੋਲ ਕਿਉਂ ਭੇਜੀ ਤੁਸੀਂ ਤੁਹਾਡਾ ਡਰਾਈਵਰ ਵੀ ਇਹੋ ਜਿਹਾ ਨਾ ਉਹਦੀ ਸਾਫ ਸਫਾਈ ਹੈ ਅਤੇ ਨਾ ਮਸਕ ਪਹਿਨ ਰੱਖਿਆ ਉਹਨੇ ਜੇ ਮੇਰੇ ਬੱਚਿਆਂ ਨੂੰ ਕੋਈ ਬਿਮਾਰੀ ਲੱਗ ਗਈ ਉਹਦਾ ਜਿੰਮੇਵਾਰ ਕੌਣ ਹੈ ਇਹਦਾ ਹੈਂ ਅਤੇ ਸਰ ਮਾੜਾ ਮੋਟਾ ਤੁਸੀਂ ਰੱਖਿਆ ਕਰੋ ਜੇ ਤੁਸੀਂ ਪੈਸੇ ਲੈ ਰਹੇ ਹੋ ਬੰਦੇ ਤੋਂ ਤਾਂ ਤੁਸੀਂ ਆਪਦੀ ਗੱਡੀ ਦੀ ਫੈਸਲਿਟੀ ਸਾਨੂੰ ਪੂਰੀ ਦਿਓ ਅਤੇ ਨਾ ਮੈਂ ਜਿੰਨੇ ਤੁਸੀਂ ਮੈਨੂੰ ਪੈਸੇ ਕਹੇ ਮੈਂ ਉੱਨੇ ਤੁਹਾਨੂੰ ਪੇਮੈਂਟ ਕਰੀ ਹੈ ਬਟ ਤੁਸੀਂ ਫਿਰ ਵੀ ਮੈਨੂੰ ਗੱਡੀ ਜਮਾ ਜੀਰੋ ਨੰਬਰ ਭੇਜੀ ਹੈ ਮੈਂ ਇਹਦੇ ਬਾਰੇ ਇਦੂੰ ਵੱਧ ਤੁਹਾਨੂੰ ਕੀ ਮਾੜਾ ਬੋਲਾਂ ਇੰਨਾ ਨਾਰਾਜ਼ ਹਾਂ ਤੁਹਾਡੀ ਗੱਡੀ ਤੋਂ ਕਿ ਅੱਜ ਤੋਂ ਬਾਅਦ ਮੈਂ ਕਦੇ ਵੀ ਤੁਹਾਡੀ ਗੱਡੀ ਆਰਡਰ ਨਹੀਂ ਕਰਾਂਗਾ ਮੈਂ ਹੋਰ ਬੰਦਿਆਂ ਨੂੰ ਕਹਾਂਗਾ ਕਿ ਇਹਨਾਂ ਦੀ ਕੰਪਨੀ ਨੂੰ ਗੱਡੀ ਦਾ ਕਦੀ ਔਡਰ ਨਾ ਦਿਓ ਕਿ ਹੋਰ ਕਿਸੇ ਡ੍ਰਾਈਵਰ ਨੂੰ ਕਹਿ ਦਿਓ ਕਿ ਭਾਈ ਸਾਨੂੰ ਲੈ ਕੇ ਜਾਓ ਪਰ ਇਹਨਾਂ ਨੂੰ ਕਦੇ ਵੀ ਔਡਰ ਨਾ ਦਿਓ